ਕਿਸਾਨ ਜਿਸ ਤਰ੍ਹਾਂ ਕਿਸਾਨ ਜਾਨਵਰ ਰੱਖਦੇ ਆ ਹੈ ਨਾ ਉਹਨਾਂ ਨੂੰ ਮਤਲਬ ਤੰਦਰੁਸਤ ਵੀ ਰਹਿਣੇ ਚਾਹੀਦੇ ਆ ਉਹਨਾਂ ਦਾ ਮਤਲਬ ਦਵਾਈ ਮੈਡ ਦਵਾਈ ਵੀ ਚਲਦੀ ਹੈ ਜਿੱਥੇ ਉਹ ਜਿਸ ਤਰ੍ਹਾਂ ਬਿਮਾਰ ਹੋ ਜਾਣ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਹੋ ਜਾਏ ਉਹ ਮਤਲਬ ਕੀ ਕਰਦੇ ਆ ਕਿ ਉਹਨਾਂ ਦੀ ਦੇਖਭਾਲ ਕਰਦੇ ਆ ਉਹਨਾਂ ਦੇ ਮਤਲਬ ਟੀਕਾ ਵਗੈਰਾ ਲਗਾਉਂਦੇ ਹੈ ਮੈਂ ਦਵਾਈ ਵਗੈਰਾ ਦਿੰਦੇ ਆ ਹਰ ਇੱਕ ਚੀਜ਼ ਉਹਨਾਂ ਦੀ ਮਤਲਬ ਰੱਖੀ ਹੁੰਦੀ ਹੈ ਤਾਂ ਕਿ ਉਹ ਇਸ ਤਰ੍ਹਾਂ ਬਿਮਾਰ ਨਾ ਹੋ ਜਾਣ ਜਾਨਵਰਾਂ ਲਈ ਬੁਰੀ ਬੇਰਹਿਮੀ ਤੋਂ ਪ੍ਰਭਾਵਿਤ ਮਤਲਬ ਉਹ ਕੋਈ ਵੀ ਉਹਨਾਂ ਨੂੰ ਗੱਲਬਾਤ ਹੋ ਜਾਏ ਅਤੇ ਉਹਨਾਂ ਨੂੰ ਮਤਲਬ ਬੜਾ ਦੁੱਖ ਹੁੰਦਾ ਹੈ ਕਿ ਸਾਡਾ ਜਾਨਵਰ ਬਿਮਾਰ ਹੋ ਗਿਆ ਜਾਂ ਮਰ ਚੁੱਕਾ ਹੈ ਉਹਨਾਂ ਦੀ ਕੁਛ ਵੀ ਇੱਦਾਂ ਦਾ ਹੁੰਦਾ ਹੈ ਕਿ ਕੁਛ ਵੀ ਨਾ ਹੋ ਸਕੇ ਸਾਡੇ ਜਾਨਵਰ ਨੂੰ ਹੁਣ ਅਸੀਂ ਘਰ ਵਿੱਚ ਜਾਨਵਰ ਰੱਖਦੇ ਹਾਂ ਅਤੇ ਉਸਦਾ ਸਾਨੂੰ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਆਪਣੇ ਤੋਂ ਵੀ ਵੱਧ ਕੇ ਸਾਨੂੰ ਖਿਆਲ ਰੱਖਣਾ ਪੈਂਦਾ ਤਾਂ ਕਿ ਇਹਨੂੰ ਵੀ ਕੋਈ ਦਿੱਕਤ ਨਾ ਹੋ ਸਕੇ ਕੋਈ ਵੀ ਇਹਨੂੰ ਬਿਮਾਰੀ ਨਾ ਲੱਗ ਸਕੇ ਜਾਂ ਇਹ ਬਿਮਾਰ ਨਾ ਹੋਏ ਕੁਛ ਵੀ ਫਿਰ ਸਾਨੂੰ ਉਹ ਕਿੱਦਾਂ ਪਤਾ ਲੱਗਦਾ ਕਿ ਸਾਡਾ ਜਿਹੜਾ ਅਸੀਂ ਘਰ ਵਿੱਚ ਜਾਨਵਰ ਰੱਖਿਆ ਉਹ ਬਿਮਾਰ ਹੈ ਬੁਰੀ ਤਰ੍ਹਾਂ ਬੇਰਹਿਮੀ ਨੂੰ ਪ੍ਰਭਾਵਿਤ ਮਤਲਬ ਲੰਘ ਚੁੱਕਾ ਕਿਉਂਕਿ ਉਹ ਸਾਨੂੰ ਉਹਨਾਂ ਤੋਂ ਪਤਾ ਲੱਗ ਜਾਂਦਾ ਉਹ ਆਪਣਾ ਖਾਣਾ ਪੀਣਾ ਥੋੜ੍ਹਾ ਛੱਡ ਦਿੰਦਾ ਹੈ ਜਾਂ ਕਿਸ ਤਰ੍ਹਾਂ ਵੀ ਵਿਵਹਾਰ ਕਰਦਾ ਸਾਨੂੰ ਉਹ ਪਤਾ ਲੱਗ ਜਾਂਦਾ ਕਿਸਾਨ ਆਪਣੇ ਬੜਾ ਮਤਲਬ ਉਹਨਾਂ ਨੇ ਹਰ ਇੰਤਜ਼ਾਮ ਕੀਤੇ ਹੁੰਦੇ ਆਪਣੇ ਸਾਰੇ ਕਿ ਡਾਕਟਰ ਨੂੰ ਬੁਲਾਉਣਾ ਹੈ ਜਾਂ ਉਹਨੂੰ ਕਿੱਦਾਂ ਟੀਕਾ ਲਗਵਾਉਣਾ ਹੈ ਡਾਕਟਰ ਨੂੰ ਬੁਲਾ ਕੇ ਉਹਨਾਂ ਨੂੰ ਚੈਕਰ ਚੈੱਕਅਪ ਕਰਾਉਣਾ ਉਹਨਾਂ ਦਾ ਟੀਕਾ ਲਗਵਾਉਣਾ ਦਵਾਈ ਦੇਣੀ ਹੈ ਫਿਰ ਉਹ ਸਾਰਾ ਆਪਣਾ ਚੈੱਕਅਪ ਕਰਵਾਉਂਦੇ ਹੈ ਜੋ ਵੀ ਉਹਨਾਂ ਨੇ ਜਾਨਵਰ ਰੱਖੇ ਹੁੰਦੇ ਹੈ ਫਿਰ ਉਹ ਚੈੱਕ ਅਪ ਕਰਵਾ ਕੇ ਡਾਕਟਰ ਕੋਲ ਦਵਾਈ ਲੈਂਦੇ ਆ ਸਾਰਾ ਕੁਛ ਕਰਾ ਕੇ ਫਿਰ ਉਹ ਤੰਦਰੁਸਤ ਹੋ ਜਾਂਦੇ ਆ